ਟੈਰਿਸ ਗਾਰਡਨਿੰਗ ਅਤੇ ਆਮ ਗਾਰਡਨਿੰਗ ਵਿੱਚ ਫਰਕ ਤਾਂ ਹੈਗਾ ਜਿਹੜੀ ਟੈਰਿਸ ਗਾਰਡਨਿੰਗ ਹੈ ਉਹ ਛੱਤ 'ਤੇ ਹੁੰਦੀ ਹੈ ਜਿਹਦੇ ਵਿੱਚ ਕੀ ਆਪਾਂ ਨੂੰ ਪਹਿਲਾਂ ਮੋਮੀ ਕਾਗਜ਼ ਵਿਛਾ ਕੇ ਉਸ ਛੱਤ ਨੂੰ ਪਾਣੀ ਦੀ ਨਮੀ ਤੋਂ ਬਚਾਉਣਾ ਪੈਂਦਾ ਹੈ ਨਹੀਂ ਤਾਂ ਜੇ ਜਦ ਪਾਣੀ ਮਿੱਟੀ ਦੇ ਵਿੱਚ ਜਾਵੇਗਾ ਤਾਂ ਉਹ ਛੱਤ ਖਰਾਬ ਕਰ ਸਕਦਾ ਹੈ ਪਰ ਆਮ ਗਾਰਡਨਿੰਗ ਦੇ ਵਿੱਚ ਆਪਾਂ ਖੁੱਲਾ ਪਾਣੀ ਅਤੇ ਖੁੱਲੀ ਮਿੱਟੀ ਵਧ ਸਕਦੇ ਹਾਂ ਟੈਰਿਸ ਗਾਰਡਨਿੰਗ 'ਚ ਆਪਾਂ ਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਪਾਣੀ ਦਾ ਜਿਹੜਾ ਖੜ੍ਹਾ ਨਹੀਂ ਸਕਦੇ ਉਹਦੇ ਵਿੱਚ ਜਿਹੜਾ ਆਮ ਗਾਰਡਨਿੰਗ ਹੈ ਉਹਦੇ ਵਿੱਚ ਪੌਦਿਆਂ ਨੂੰ ਜ਼ਿਆਦਾ ਤਰ੍ਹਾਂ ਦਾ ਜਿਹੜਾ ਖਾਦ ਹੈ ਉਹ ਪਾ ਸਕਦੇ ਹਾਂ ਪਰ ਟੈਰਿਸ ਗਾਰਡਨਿੰਗ ਦੇ ਵਿੱਚ ਆਪਾਂ ਨੂੰ ਦੇਖਣਾ ਪੈਣਾ ਕਿ ਜੇ ਆਪਾਂ ਖਾਦ ਪਾਈਏ ਤਾਂ ਉਹ ਕਿਤੇ ਲੀਕ ਕਰਕੇ ਛੱਤ 'ਚ ਨਾ ਵੜ ਜਾਏ ਅਤੇ ਛੱਤ ਦਾ ਕੰਮ ਖਰਾਬ ਹੋ ਸਕਦਾ